ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂ ਸਬਜ਼ੀ ਵਾਲੇ ਆ ਭਾਈ ਹੈਗੀਆਂ ਬਾਈ ਕਿਹੜੀ ਕਿਹੜੀ ਸਬਜ਼ੀ ਚਾਹੀਦੀ ਹੈ ਤੁਹਾਨੂੰ ਕਿਹੜੀ ਕਿਹੜੀ ਸਬਜ਼ੀ ਲੈਣੀ ਹੈ ਅੱਛਾ ਜੀ ਹੋਰ ਰੇਟ ਤਾਂ ਦੇ ਦਿਆਂਗੇ ਤੁਹਾਨੂੰ ਸਬਜ਼ੀ ਵੀ ਦੇ ਦਿਆਂਗੇ ਮਟਰਾਂ ਦਾ ਹਾਂ ਮਟਰਾਂ ਦਾ ਰੇਟ ਤਾਂ ਤੁਹਾਨੂੰ ਪਤਾ ਹੀ ਹੈ ਆਪਣਾ ਪੰਜਾਹ ਰੁਪਏ ਤੋਂ ਥੱਲੇ ਤਾਂ ਅੱਜ ਕੱਲ੍ਹ ਕੋਈ ਭਾਈ ਸਬਜ਼ੀ ਮਿਲਦੀ ਨਹੀਂ ਹਾਂ ਪੰਜਾਹ ਰੁਪਏ ਆਲੂ ਲੈ ਜਿਓ ਤੀਹ ਰੁਪਏ ਕਿੱਲੋ ਆਲੂ ਹੈ ਭਾਈ ਹੋਰ ਹੋਰ ਕੀ ਚਾਹੀਦਾ ਭੇਜ ਦਿਆਂਗੇ ਭਾਈ ਦੇ ਦਿਆਂਗੇ ਤੁਹਾਨੂੰ ਚਾਲ੍ਹੀ ਰੁਪਏ ਕਰੀਬ ਚਾਲ੍ਹੀ ਰੁਪਏ ਕਿੱਲੋ ਆਥਣ ਤੱਕ ਪਹੁੰਚਾ ਦਿਆਂਗੇ ਤੁਹਾਡੇ ਕੋਲ ਅਤੇ ਤੁਹਾਡਾ ਭਾਈ ਸਾਨੂੰ ਉਹ ਦੱਸ ਦਿਓ ਵੀ ਕਰਨਾ ਕਿਆ ਜੇ ਰੱਖਣੀ ਹੈ ਸਬਜ਼ੀ ਤੁਸੀਂ ਉਸ ਹਿਸਾਬ ਨਾਲ ਭੇਜਾਂਗੇ ਫਿਰ ਹਾਂ ਭਿੰਡੀ ਭੇਜ ਦਿਆਂਗੇ ਜੀ ਭਿੰਡੀ ਹੈਗੀ ਹੈ ਭਿੰਡੀ ਦਾ ਰੇਟ ਭਾਈ ਭਿੰਡੀ ਦਾ ਰੇਟ ਤਾਂ ਪੈਂਤੀ ਰੁਪਏ ਕਿੱਲੋ ਹੈ ਭਾਈ ਹਾਂਜੀ ਹੋਰ ਦੱਸੋ ਖੀਰਾ ਚਾਹੀਦਾ ਕੱਦੂ ਚਾਹੀਦਾ

ਹਾਂਜੀ ਹਾਂਜੀ ਤਿੰਨ ਕਿੱਲੋ ਚਾਹੀਦਾ ਖੀਰਾ ਹਾਂ ਅਤੇ ਕੱਦੂ ਕੱਦੂ ਪੰਜ ਕਿੱਲੋ ਕੱਦੂ ਤੁਹਾਨੂੰ ਦੇ ਦਿਆਂਗੇ ਚਲੋ ਤੀਹ ਰੁਪਏ ਕਰੀਬ ਡੇਢ ਸੌ ਨੂੰ ਦੇ ਦਿਆਂਗੇ ਤੁਹਾਨੂੰ ਹੋਰ ਦੱਸੋ ਜੀ

ਸਬਜ਼ੀਆਂ ਸਾਡੇ ਕੋਲ ਸਾਰੀਆਂ ਹੋਰ ਕੋਈ ਟਮਾਟਰ ਸ਼ਮਾਟਰ ਕੋਈ ਲੈਣੇ ਹੈ ਜੀ ਤੁਸੀਂ ਹੋਰ ਦੱਸੋ ਸਾਡੀ ਦੁਕਾਨ 'ਤੇ ਹਾਂਜੀ ਹੋਰ ਪਰਸੋਂ ਕੱਲ੍ਹ ਕੱਲ੍ਹ ਐਤਵਾਰ ਹੈ ਪਰਸੋਂ ਨੂੰ ਭੇਜ ਦਿਆਂਗੇ ਜੀ ਤੁਹਾਡੇ ਕੋਲ ਹਾਂ